ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕਈ ਪ੍ਰਕਾਰ ਦੇ ਅਭਿਆਸਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਕਿ ਸਾਨੂੰ ਆਪਣੇ ਆਸ ਪਾਸ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਆਸ ਪਾਸ ਦੀਆਂ ਨਾਲੀਆਂ ਹਮੇਸ਼ਾ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਆਪਣੇ ਘਰ ਦੇ ਆਸ ਪਾਸ ਕਦੇ ਵੀ ਕੂੜਾ ਕਰਕਟ ਨਹੀਂ ਸੁੱਟਣਾ ਚਾਹੀਦਾ ਹੈ ਆਸ ਪਾਸ ਦੇ ਇਲਾਕਿਆਂ ਨੂੰ ਸੁੱਕਾ ਰੱਖਣਾ ਚਾਹੀਦਾ ਹੈ ਘਰ ਦੇ ਵਿੱਚ ਕੋਈ ਵੀ ਐਸੀ ਚੀਜ਼ ਨਾ ਹੋਵੇ ਜੋ ਕੁਛ ਦਿਨਾਂ ਤੋਂ ਪਈ ਰਵੇ ਜਾਂ ਕਿ ਆਪਣੇ ਘਰ ਦੇ ਵਿੱਚ ਕੋਈ ਐਸਾ ਸਥਾਨ ਨਾ ਹੋਵੇ ਜਿੱਥੇ ਕਈ ਦਿਨਾਂ ਤੱਕ ਪਾਣੀ ਪਿਆ ਰਹੇ ਅਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਸਾਨੂੰ ਮੱਛਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਘਰ ਦੇ ਵਿੱਚ ਮੱਛਰਦਾਨੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਹਮੇਸ਼ਾ ਤਾਜ਼ੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਆਪਣੀ ਟੈਂਕੀਆਂ ਨੂੰ ਸਾਫ਼ ਸੁਥਰੇ ਕਰਦੇ ਰਹਿਣਾ ਚਾਹੀਦਾ ਹੈ ਪਾਣੀ ਕਿਤੇ ਵੀ ਖੜਾ ਨਹੀਂ ਹੋਣਾ ਚਾਹੀਦਾ ਹੈ ਆਪਣੇ ਰੋਡ ਗਲੀਆਂ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਨਾਲੀਆਂ ਹਮੇਸ਼ਾ ਵਗਦੀਆਂ ਰਹਿਣੀਆਂ ਚਾਹੀਦੀਆਂ ਹਨ ਕਿਤੇ ਵੀ ਕੂੜਾ ਕਰਕਟ ਨਾ ਹੋਏ ਆਸ ਪਾਸ ਰੋਜ਼ ਰੋਜ਼ਾਨਾ ਆਪਣੇ ਘਰਾਂ ਦੀ ਸਾਫ਼ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ ਸੋਣ ਵੇਲੇ ਆਪਣੇ ਕੋਲ ਮੱਛਰਦਾਨੀਆਂ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਬਿਮਾਰੀਆਂ ਜਿਵੇਂ ਕੀ ਆਮ ਜੁਕਾਮ ਫਲੂ ਮਲੇਰੀਆ ਚਿਕਨਗੁਨੀਆ ਡੇਂਗੂ ਇਹ ਸਭ ਵੀ ਇਹਨਾਂ ਨਾਲ ਹੋ ਸਕਦੇ ਹਨ ਇਹਨਾਂ ਤੋਂ ਬਚਣ ਲਈ ਕਈ ਪ੍ਰਕਾਰ ਦੇ ਅਭਿਆਸਾਂ ਦਾ ਪਾਲਣਾ ਕਰਨੀ ਚਾਹੀਦੀ ਹੈ ਅਭਿਆਸਾਂ ਦੀ ਪਾਲਣਾ ਇਸ ਤਾ ਕਰਨੀ ਚਾਹੀਦੀ ਹੈ ਕਿ ਸਾਫ਼ ਸਫਾਈ ਰੱਖੀ ਜਾਵੇ ਕੋਈ ਵੀ ਆਪਣੇ ਆਸ ਪਾਸ ਗੰਦਗੀ ਨਾ ਸੁੱਟੋ ਕੋਈ ਵੀ ਕੂੜਾ ਨਾ ਸੁੱਟੋ ਘਰ ਦੇ ਵਿੱਚ ਪੁਰਾਣੀਆਂ ਚੀਜ਼ਾਂ ਨਾ ਰੱਖੋ ਬਿਨਾਂ ਢੱਕ ਕੇ ਇਹ ਚੀਜ਼ਾਂ ਨੂੰ ਨਾ ਰੱਖੋ ਆਪਣੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਢੱਕ ਕੇ ਰੱਖੋ ਪਾਣੀ ਪੂਣੀ ਨੂੰ ਹਮੇਸ਼ਾ ਢੱਕ ਕੇ ਰੱਖੋ ਇਹਨਾਂ ਨੂੰ ਕਦੇ ਵੀ ਬਿਨਾਂ ਢਕੇ ਹੋਏ ਨਹੀਂ ਰੱਖਣਾ ਚਾਹੀਦਾ ਹੈ ਆ ਕੋਈ ਵੀ ਬਾਸੀ ਚੀਜ਼ ਨਹੀਂ ਖਾਣੀ ਚਾਹੀਦੀ ਹੈ ਹਮੇਸ਼ਾ ਤਾਜ਼ੀਆਂ ਚੀਜ਼ਾਂ ਤਾਜ਼ੇ ਫਲਾਂ ਦਾ ਪ੍ਰਯੋਗ ਕਰੋ ਤਾਜ਼ੇ ਪਾਣੀ ਦਾ ਪ੍ਰਯੋਗ ਕਰੋ